ਹਾਂਜੀ ਮੇਰੇ ਖੇਤਰ ਵਿੱਚ ਉਪਕਰਨ ਵਾਲੇ ਬਹੁਤ ਸਾਰੇ ਮੁੱਖ ਕਲਾਰੂਪ ਅਤੇ ਸ਼ੈਲੀਆਂ ਹਨ ਜਿੰਨ੍ਹਾਂ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ ਜਿਵੇਂ ਕਿ ਮੇਰੇ ਘਰ ਵਿੱਚ ਬਹੁਤ ਸਾਰੀਆਂ ਸ਼੍ਰੀ ਹਰਿਮੰਦਰ ਸਾਹਿਬ ਹੋਰ ਵੀ ਗੁਰੂਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਨੂੰ ਪ੍ਰੰਪਰਾਗਤ ਕਿਹਾ ਜਾਂਦਾ ਹੈ ਜੋ ਕਿ ਮੈਂ ਆਪਣੇ ਧਰਮ ਲਈ ਲਾਈਆਂ ਹੋਈਆਂ ਨੇ ਪਾਠ ਕਰਨ ਲਈ ਲਾਈਆਂ ਹੋਈਆਂ ਹਨ ਜੇ ਜੋ ਵੀ ਕਿਸੇ ਵੀ ਗੁਰੂ ਨੂੰ ਮੰਨਦੇ ਹਨ ਜਾਂ ਜਿਵੇਂ ਕੋਈ ਲੋਕ ਹਿੰਦੂ ਹਨ ਜੋ ਵੀ ਆਪਣੇ ਗੁਰੂ ਨੂੰ ਮੰਨਦੇ ਹਨ ਉਹਨਾਂ ਨੇ ਆਪਣੇ ਦੀ ਤਸਵੀਰਾਂ ਲਗਾਈਆਂ ਹੁੰਦੀਆਂ ਹਨ ਘਰ ਵਿੱਚ ਦੂਸਰੇ ਪਾਸੇ ਅਸੀਂ ਦੇਖਿਆ ਤਾਂ ਸਮਕਾਲੀ ਕਈ ਲੋਕਾਂ ਦਾ ਕਿੱਤਾ ਹੁੰਦਾ ਹੈ ਜਿਵੇਂ ਕਿ ਲੋਕ ਟੈਕਨੋਲਜੀ ਦੀ ਮਦਦ ਨਾਲ ਤਸਵੀਰਾਂ ਪ੍ਰਿੰਟ ਕਢਾਉਂਦੇ ਹਨ ਮਨ ਆਪਣੇ ਮਨ ਲਈ ਆਪਣੇ ਮਨ ਨੂੰ ਖੁਸ਼ ਕਰਨ ਲਈ ਤਸਵੀਰਾਂ ਬਣਾਉਂਦੇ ਹਨ ਜਾਂ ਆਪਣੇ ਪੈਸੇ ਕਮਾਉਣ ਲਈ ਤਸਵੀਰਾਂ ਬਣਾਉਂਦੇ ਹਨ ਉਨ੍ਹਾਂ ਨੂੰ ਸਮਕਾਲੀ ਕਿਹਾ ਜਾਂਦਾ ਹੈ ਜਾਂ ਬਹੁਤ ਸਾਰੇ ਲੋਕਾਂ ਨੇ ਆਪਣੇ ਘਰ ਦੀ ਸਜਾਵਟ ਲਈ ਇਹ ਤਸਵੀਰਾਂ ਲਗਾਈਆਂ ਹੁੰਦੀਆਂ ਹਨ ਮੇਰੇ ਘਰ ਵੀ ਵਿੱਚ ਵੀ ਬਹੁਤ ਸਾਰੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ ਇਵੇਂ ਦੀਆਂ ਜੋ ਮੇਰੇ ਘਰ ਨੂੰ ਸੋਹਣਾ ਬਣਾਉਂਦੀਆਂ ਹਨ ਇਸ ਤਰ੍ਹਾਂ ਲੋਕਾਂ ਨੇ ਬਹੁਤ ਸਾਰੀਆਂ ਤਸਵੀਰਾਂ ਲਗਾਈਆਂ ਹੁੰਦੀਆਂ ਹਨ ਜੋ ਬਹੁਤ ਹੀ ਮਨਪ੍ਰਚਲਿਤ ਹੁੰਦੀਆਂ ਹਨ ਦਿਲਚਸਪ ਹੁੰਦੀਆਂ ਹਨ ਦੇਖ ਕੇ ਵੀ ਬਹੁਤ ਅੱਛਾ ਲੱਗਦਾ ਹੈ ਧੰਨਵਾਦ